ਮੇਰਾ ਨਾਮ ਰਾਕੇਸ਼ ਹੈ ਮੈਂ ਪਠਾਨਕੋਟ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ ਅਤੇ ਜੇ ਮੈਂ ਗੱਲ ਕਰਾਂ ਕਿ ਮੈਂ ਸਕੂਲ ਜਾਂ ਆਪਣੇ ਕਾਲਜ ਦੇ ਵਿੱਚ ਭਾਰਤੀ ਵਿਗਿਆਨ ਬਾਰੇ ਕੁਝ ਸਿੱਖਿਆ ਹੈ ਤਾਂ ਇਹਦਾ ਉੱਤਰ ਮੈਂ ਹਾਂ ਵਿੱਚ ਦੇਵਾਂਗੀ ਭਾਰਤੀ ਵਿਗਿਆਨ ਬਾਰੇ ਬਹੁਤ ਕੁਝ ਸਿੱਖਿਆ ਹੈ ਅਤੇ ਮੈਂ ਤੁਹਾਨੂੰ ਮਸ਼ਹੂਰ ਭਾਰਤੀ ਵਿਗਿਆਨ ਅਤੇ ਭਾਰਤੀ ਗਣਿਤ ਸ਼ਾਸਤਰੀ ਬਾਰੇ ਦੱਸਣ ਜਾ ਰਹੀ ਹਾਂ ਜਿਵੇਂ ਕਿ ਕੁਝ ਮਸ਼ਹੂਰ ਭਾਰਤੀ ਵਿਗਿਆਨਾਂ ਦੇ ਨਾਮ ਹਨ ਜਿਸ ਵਿੱਚੋਂ ਮੈਂ ਸ ਸਤੀਸ਼ ਧਵਨ ਜੀ ਬਾਰੇ ਪੜ੍ਹਿਆ ਹੈ ਉਹ ਭਾਰਤੀ ਖਗੋਲ ਵਿਗਿਆਨੀ ਸਨ ਜਿਹਨਾਂ ਨੇ ਪ੍ਰਥਮ ਭਾਰਤੀ ਉਪਗ੍ਰਹਿ ਚੰਦਰਿਆ ਨੂੰ ਲਿਆਂਦਾ ਹੈ ਬਹੁਤ ਸਾਰੇ ਅਧਿਅਨ ਅਤੇ ਅਧਿਕਾਰੀ ਰਹੇ ਹਨ ਅਤੇ ਮੈਂ ਆਪ ਅਪਜਦ ਖਾਨ ਬਾਰੇ ਪੜ੍ਹਿਆ ਹੈ ਜੋ ਭਾਰਤੀ ਖਗੋਲ ਦੇ ਮਸ਼ਹੂਰ ਵਿਗਿਆਨੀ ਸਨ ਜਿਹਨਾਂ ਨੇ ਭਾਰਤੀ ਉਪਗ੍ਰਹਿ ਅਨਕਲਾਂ ਨੂੰ ਲਿਆਉਂਦਾ ਅਤੇ ਖਗੋਲੀਆਂ ਦੇ ਪ੍ਰਥਮ ਸਮੁੱਚੇ ਸਰੂਪ ਦੇਖਣ ਦੀ ਸਫਲਤਾ ਵੀ ਹਾਸਿਲ ਕੀਤੀ ਅਤੇ ਤੀਸਰੇ ਵਿਗਿਆਨੀ ਸਨ ਜਿਹਨਾਂ ਬਾਰੇ ਮੈਂ ਪੜ੍ਹਿਆ ਹੈ ਉਹ ਹਨ ਐਲੈਨ ਸਾਕਾਰ ਜੋ ਪ੍ਰਸਿੱਧ ਭਾਰਤੀ ਗਣਿਤ ਵਿਗਿਆਨੀ ਸਨ ਜਿਹਨਾਂ ਨੇ ਬ੍ਰੇਨ ਸਟਾਰ ਹਾਸਟ ਰਣਕੇ ਬਾਰੇ ਖਾਸ ਜਾਣਕਾਰੀ ਦੇ ਕੇ ਬਰੀਜ ਆਫ ਐਨਾਲਾਈਸਿਸ ਦੀ ਪ੍ਰਸਿੱਧ ਪ੍ਰਸਿੱਧੀ ਪ੍ਰਾਪਤ ਕੀਤੀ ਅਤੇ ਇੱਕ ਹੋਰ ਵਿਗਿਆਨੀ ਬਾਰੇ ਜਾਣਕਾਰੀ ਰੱਖਦੀ ਹਾਂ ਜਿਹਨਾਂ ਦਾ ਨਾਮ ਹੈ ਸੁਭਾਸ਼ ਖੰਨਾ ਜੋ ਭਾਰਤੀ ਰੇਡੀਓ ਖਗੋਲ ਵਿਗਿਆਨੀ ਸਨ ਜਿਹਨਾਂ ਨੇ ਪ੍ਰਥਮ ਭਾਰਤੀਏ ਖਗੋਲ ਸੈਂਟਰ ਵਿੱਚ ਸਫਲਤਾ ਹਾਸਿਲ ਕੀਤੀ ਇਹ ਕੁਝ ਨਾਮ ਸਨ ਜੋ ਭਾਰਤੀ ਸਿੱਖਿਆ ਵਿੱਚ ਜਿਹਨਾਂ ਨੇ ਲੋਕਾਂ ਨੂੰ ਬਹੁਤ ਮਿਹਨਤ ਕੀਤੀ ਜੋ ਕਿ ਖੋ ਖਗੋਲ ਅਤੇ ਗਣਿਤ ਵਿਗਿਆਨ ਵਿੱਚ ਬਹੁਤ ਮਸ਼ਹੂਰ ਵਿਗਿਆਨੀ ਸਨ ਇਸ ਦੇ ਨਾਲ ਹੀ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ ਧੰਨਵਾਦ